ਅੱਠ ਫਰਵਰੀ ਉੱਨ੍ਹੀ ਸੌ ਇਕਿਆਸੀ ਪੰਜ ਜੁਲਾਈ ਦੋ ਹਜ਼ਾਰ ਇੱਕੀ ਪੰਜ ਸਤੰਬਰ ਦੋ ਹਜ਼ਾਰ ਦੋ ਇੱਕੀ ਅਕਤੂਬਰ ਦੋ ਹਜ਼ਾਰ ਚਾਰ ਨੌ ਜੂਨ ਦੋ ਹਜ਼ਾਰ ਦਸ